ਮੈਂ ਇੱਕ ਮਹੀਨੇ ਪਹਿਲਾਂ ਵੋਚ ਔਡਰ ਕੀਤੀ ਸੀ ਆਪਣੇ ਹਸਬੈਂਡ ਲਈ ਉਹਨਾਂ ਦੇ ਬਰਡੇ 'ਤੇ ਦੇਣੀ ਸੀ ਬਰਡੇ ਤੋਂ ਮੈਂ ਪੰਦਰ੍ਹਾਂ ਦਿਨ ਪਹਿਲਾਂ ਔਡਰ ਕੀਤਾ ਸੀਗਾ ਉਸ ਤੋਂ ਬਾਵਜੂਦ ਵੀ ਮੈਨੂੰ ਪੰਦਰ੍ਹਾਂ ਦਿਨ ਬਾਅਦ ਪਹਿਲਾਂ ਤਾਂ ਔਨਲਾਈਨ ਜੋ ਆਪਾਂ ਕੋਈ ਵੀ ਚੀਜ਼ ਮੰਗਵਾਉਂਦੇ ਹਾਂ ਉਹ ਉਲਟਾ ਹੁੰਦਾ ਮਤਲਬ ਉੱਥੇ ਡਿਲੀਵਰੀ ਟਾਈਮ ਕੁਛ ਹੋਰ ਦਿਖਾਉਂਦੇ ਹੈ ਡੇਟ ਜੋ ਹੈ ਔਰ ਆਉਂਦੀ ਚੀਜ਼ ਉਲਟੀ ਹੈ ਮਤਲਬ ਉਸ ਤੋਂ ਵੀ ਇੱਕ ਹਫਤਾ ਜਾਂ ਪੰਦਰ੍ਹਾਂ ਦਿਨ ਬਾਅਦ ਆਉਂਦੀ ਹੈ ਦੂਸਰੀ ਚੀਜ਼ ਜੋ ਮੈਨੂੰ ਸਭ ਤੋਂ ਅੱਛੀ ਨਹੀ ਲੱਗੀ ਉਹ ਹੈ ਕਿ ਮੈਂ ਉਦੋਂ ਕੈਸ਼ ਔਨ ਡਿਲੀਵਰੀ ਕੀਤਾ ਸੀਗਾ ਔਡਰ ਕਰਦੇ ਹੋਏ ਉਹਨਾਂ ਨੇ ਜਦੋਂ ਮਤਲਬ ਮੈਨੂੰ ਦੇਣ ਲਈ ਆਏ ਉਹ ਡਿਲੀਵਰੀ ਕਰਨ ਆਏ ਵੋਚ ਦੀ ਅਤੇ ਉਦੋਂ ਉਹਨਾਂ ਨੇ ਮੈਨੂੰ ਕੁਛ ਹੋਰ ਹੀ ਪ੍ਰਾਈਜ਼ ਦੱਸ ਤਾ ਉਹਦਾ ਉਸ ਵੋਚ ਦਾ ਹੈ ਨਾ ਅਤੇ ਮੈਂ ਕੀਤ ਦੇਖਿਆ ਮੈਂ ਕੁਛ ਹੋਰ ਸੀ ਦੇਖ ਕੇ ਜੋ ਪ੍ਰਾਈਜ ਸੀਗਾ ਉਹ ਬਹੁਤ ਘੱਟ ਸੀਗਾ ਅਤੇ ਜਦੋਂ ਮੇਰੇ ਤੋਂ ਕੈਸ਼ ਔਨ ਡਿਲੀਵਰੀ ਮੰਗ ਰਹੇ ਸੀ ਉਹ ਬਹੁਤ ਜ਼ਿਆਦਾ ਮਤਲਬ ਸੌ ਡੇਢ ਸੌ ਰੁਪਏ ਜ਼ਿਆਦਾ ਸੀ ਚਲੋ ਉਹ ਕੋਈ ਨਹੀਂ ਬਟ ਜੋ ਚੀਜ਼ ਤੁਸੀਂ ਦਿਖਾ ਰਹੇ ਉਹੀ ਚੀਜ਼ ਤੁਹਾਨੂੰ ਦੇਣੀ ਚਾਹੀਦੀ ਹੈ ਔਰ ਉਦੋਂ ਜੋ ਵੋਚ ਮੈਂ ਪਸੰਦ ਕੀਤੀ ਸੀਗੀ ਉਹ ਤਾਂ ਬਿਲਕੁਲ ਹੀ ਮਤਲਬ ਥਰਡ ਕਲਾਸ ਮਤਲਬ ਥਰਡ ਜੋ ਘਟੀਆ ਵਾਲੀਆਂ ਚੀਜ਼ਾਂ ਸੀਗੀਆਂ ਨਾ ਉਹ ਭੇਜ ਤੀ ਉਹਨਾਂ ਨੇ ਵੋਚ ਔਰ ਪੈਸੇ ਮੇਰੇ ਤੋਂ ਐਕਸਟਰਾ ਲੈ ਲਏ ਉਹਨੇ ਦੋ ਸੌ ਢਾਈ ਸੌ ਰੁਪਏ ਔਰ ਅਤੇ ਉਸ 'ਚ ਕੁਆਲਿਟੀ ਜੋ ਸੀਗੀ ਉਹਦੀ ਬਹੁਤ ਲੋਅ ਸੀਗੀ ਵੋਚ ਦੀ ਨਾ ਮਤਲਬ ਮੇਰੇ ਮੈਨੂੰ ਤਾਂ ਬਹੁਤ ਭੈੜਾ ਐਕਸਪੀਰੀਅੰਸ ਹੈ ਮੇਰਾ ਔਨਲਾਈਨ ਜੋ ਮੈਂ ਵੋਚ ਔਡਰ ਕੀਤੀ ਬਸ ਥੈਂਕ ਯੂ ਜੀ